ਬੁਨਾਈ ਨਾਲ ਸੰਬੰਧਿਤ ਮੇਰੇ ਕੋਲੋਂ ਕਾਫੀ ਕੁਝ ਟੀਚੇ ਅਤੇ ਇੱਛਾਵਾਂ ਵੀ ਹਨ ਬਣਾਉਂਦੀ ਰਹਿਨੀ ਹਾਂ ਅਤੇ ਅੱਗੇ ਵੀ ਬਣਾਉਂਦੀ ਰਵਾਂਗੀ